ਭਾਰਤ ਵੱਖ ਵੱਖ ਰਾਜਾਂ ਦਾ ਸੰਘ ਹੈ ਇਸ ਕਰਕੇ ਇੱਥੇ ਵੱਖ ਵੱਖ ਤਰ੍ਹਾਂ ਦੇ ਪਕਵਾਨ ਵੀ ਪਾਏ ਜਾਂਦੇ ਨੇ ਜੇ ਆਪਾਂ ਗੱਲ ਕਰੀਏ ਉੱਤਰੀ ਭਾਰ ਭਾਰਤੀ ਖਾਣੇ ਦੀ ਤਾਂ ਬਹੁਤ ਇੱਥੇ ਪੰਜਾਬ ਦਾ ਇਲਾਕਾ ਪਾਇਆ ਜਾਂਦਾ ਜਿਵੇਂ ਅ ਅਸੀਂ ਪੰਜਾਬੀ ਹਾਂ ਤਾਂ ਸਾਨੂੰ ਸਾਗ ਮੱਖਣੀ ਦੁੱਧ ਨਾਲ਼ ਬਣੇ ਹੋਏ ਪ੍ਰੋਡਕਟ ਜਿਵੇਂ ਪਨੀਰ ਹੋ ਗਿਆ ਦਹੀਂ ਹੋ ਗਿਆ ਮੱਖਣ ਹੋ ਗਿਆ ਦੁੱਧ ਨਾਲ਼ ਬਣੀਆਂ ਹੋਈਆਂ ਮਠਿਆਈਆਂ ਜਿਵੇਂ ਖੋਆ ਹੋ ਗਿਆ ਬਰਫ਼ੀ ਲੱਡੂ ਏ ਇੱਦਾਂ ਦੀਆਂ ਜਿਹੜੀਆਂ ਦੁੱਧ ਤਿੱਲਾਂ ਨਾਲ਼ ਬਣੇ ਹੋਏ ਪ੍ਰੋਡਕਟ ਜਿਹੜੇ ਆ ਕਾਫ਼ੀ ਲੋਕ ਪਸੰਦ ਕਰਦੇ ਨੇ ਜੇ ਆਪਾਂ ਦੱਖਣੀ ਭਾਰਤ ਦੀ ਗੱਲ ਕਰੀਏ ਤਾਂ ਉੱਥੇ ਬਹੁਤ ਸਾਰੇ ਹੋਰ ਹਰ ਇੱਕ ਇਲਾਕੇ ਦਾ ਆਪਣਾ ਇੱਕ ਫੇਵਰੇਟ ਫੂਡ ਹੁੰਦਾ ਏ ਆ ਫੇਮਸ ਫੂਡ ਹੁੰਦਾ ਏ ਆ ਜਿਵੇਂ ਦੱਖਣੀ ਭਾਰਤ ਦੇ ਵਿੱਚ ਚਾਵਲ ਦੀ ਪੈਦਾਵਾਰ ਜ਼ਿਆਦਾ ਹੋਣ ਕਰਕੇ ਉੱਥੋਂ ਦੇ ਲੋਕ ਚਾਵਲ ਖਾਣਾ ਜ਼ਿਆਦਾ ਪਸੰਦ ਕਰਦੇ ਨੇ ਉੱਥੇ ਨਾਰੀਅਲ ਦੀ ਖੇਤੀ ਕੀਤੀ ਜਾਂਦੀ ਹੈ ਤਾਂ ਕਰਕੇ ਨਾਰੀਅਲ ਤੋਂ ਬਣੀਆਂ ਹੋਈਆਂ ਚੀਜ਼ਾਂ ਜਿਵੇਂ ਕਿ ਨਾਰੀਅਲ ਦੀ ਬਰਫ਼ੀ ਹੋ ਗਈ ਨਾਰੀਅਲ ਦਾ ਦੁੱਧ ਜਿਵੇਂ ਦੁੱਧ ਨਾਲ਼ ਬਣੀਆਂ ਹੋਈਆਂ ਮਠਿਆਈਆਂ ਹੋਗੀਆਂ ਤਾਂ ਉਹਨਾਂ ਚੀਜ਼ਾਂ ਨੂੰ ਜ਼ਿਆਦਾ ਲੋਕ ਪ੍ਰੈਫਰ ਕਰਦੇ ਨੇ ਅਗਰ ਮੇਰੀ ਮਨਪਸੰਦ ਡਿਸ਼ ਦਾ ਮੈਂ ਨਾਮ ਦੱਸਾਂ ਤਾਂ ਉਹ ਆ ਸਾਂਬਰ ਮੈਂ ਮੈਂ ਜਦੋਂ ਵੀ ਸਾਂਬਰ ਬਣਾਉਂਦੀ ਹਾਂ ਤਾਂ ਮੈਂ ਆਪਣੇ ਜਿਹੜੇ ਮੇਰੇ ਰਿਲੇਟਿਵਸ ਮੇਰੇ ਘਰ ਆਉਂਦੇ ਨੇ ਮੈਂ ਉਹਨਾਂ ਨੂੰ ਸਰਵ ਕਰਦੀ ਹਾਂ ਅਤੇ ਉਹ ਮੇਰੀ ਬਹੁਤ ਤਾਰੀਫ਼ ਕਰਦੇ ਨੇ